ਛੋਟਾ ਹੁੰਦਾ ਜਦੋਂ ਮੈਂ ਪੰਜਵੀਂ ਜਮਾਤ ਦੇ ਵਿੱਚ ਹੁੰਦਾ ਸੀ ਤਾਂ ਮੈਂ ਆਪਣੇ ਮਿੱਤਰਾਂ ਨੂੰ ਇੱਕ ਗਾਣਾ ਗਾ ਕੇ ਦਿਖਾਇਆ ਜਿਸ ਵਿੱਚ ਉਹਨਾਂ ਨੇ ਮੈਨੂੰ ਗਾਣੇ ਗਾਉਣ ਤੋਂ ਬਾਅਦ ਉਹਨਾਂ ਨੇ ਮੇਰੀ ਕਾਫ਼ੀ ਤਾਰੀਫ਼ ਕੀਤੀ ਕਿ ਤ ਤੇਰੀ ਆਵਾਜ਼ ਬਹੁਤ ਵਧੀਆ ਹੈ ਤੇਰੇ ਸੁਰ ਬਹੁਤ ਵਧੀਆ ਨੇ ਤਾਂ ਉਸ ਤੋਂ ਮੈਨੂੰ ਗਾਉਣ ਦੀ ਉਸ ਟਾਈਮ ਤੋਂ ਰੁਚੀ ਬਣੀ ਹੌਲੀ ਹੌਲੀ ਮੈਂ ਆਪਣੀ ਆਵਾਜ਼ ਨੂੰ ਸੰਭਾਲਦਾ ਰਿਹਾ ਅਤੇ ਗਾਇਕੀ ਵੱਲ ਵੱਧਦਾ ਰਿਹਾ ਉਸ ਟਾਈਮ ਤੋਂ ਮੈਨੂੰ ਗਾਇਕੀ ਨੇ ਖਿੱਚ ਲਿਆ